ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਹੋਟਲ ਮਾਣ ਹੋਟਲ ਤੋਂ ਬੋਲਦੇ ਹੋ ਅਤੇ ਅਸੀਂ ਉਥੋਂ ਸਮਾਨ ਮੰਗਵਾਇਆ ਸੀ ਬਰਗਰ ਪੀਜ਼ਾ ਅਤੇ ਸਾਡੇ ਕੋਲ ਹਜੇ ਨਹੀਂ ਪਹੁੰਚਿਆ ਅਤੇ ਇੱਕ ਵਜੇ ਦਾ ਟਾਈਮ ਦਿੱਤਾ ਸੀ ਤਿੰਨ ਵੱਜ ਗਏ ਬਹੁਤ ਲੇਟ ਹੋ ਗਏ ਅਤੇ ਤੁਸੀਂ ਤਾਂ ਆਖਦੇ ਸੀ ਵੀ ਸਾਡਾ ਸਮਾਨ ਜੋ ਵੀ ਜਾਂਦਾ ਬਹੁਤ ਟਾਈਮ 'ਤੇ ਪਹੁੰਚਦਾ ਅਤੇ ਸਾਜੇ ਸਾਡੇ ਕੋਲ ਕੋਈ ਤੁਹਾਡਾ ਸਮਾਨ ਨਹੀਂ ਪਹੁੰਚਿਆ ਅਤੇ ਸਾਨੂੰ ਛੇਤੀ ਤੋਂ ਛੇਤੀ ਦੱਸੋ ਵੀ ਤੁਹਾਡਾ ਜਿਹੜਾ ਸਮਾਨ ਹੈ ਵੀ ਸਾਡੇ ਕੋਲ ਕਦੋਂ ਪਹੁੰਚ ਸਕਦਾ ਅਤੇ ਬਹੁਤ ਲੇਟ ਹੋ ਗਏ ਅਤੇ ਨਹੀਂ ਅਸੀਂ ਆਪਣੇ ਖਾਣੇ ਦਾ ਫਿਰ ਅਸੀਂ ਹੋਰ ਕਿਸੇ ਨੂੰ ਪਾਸਿਓਂ ਕੋਈ ਆਪਣਾ ਘਰ ਬਣਾ ਕੇ ਜਾਂ ਇੰਤਜ਼ਾਮ ਕਰਕੇ ਅਤੇ ਜੇ ਤੁਸੀਂ ਪਹੁੰਚਾ ਸਕਦੇ ਹੋ ਅਤੇ ਸਾਨੂੰ ਛੇਤੀ ਤੋਂ ਛੇਤੀ ਸਮਾਨ ਪਹੁੰਚਾਓ ਅਤੇ ਜਾਂ ਦੱਸੋ